ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਹਾਂਜੀ ਹਾਂ ਉਹ ਤਾਂ ਜਿਸ ਜਿਸ ਤਰ੍ਹਾਂ ਦਾ ਫੰਕਸ਼ਨ ਹੋਏਗਾ ਸਟੈੱਪ ਬਾਏ ਸਟੈੱਪ ਉਸ ਤਰ੍ਹਾਂ ਹੀ ਛੂਟ ਕਰਨਾ ਪਏਗਾ ਨਾ ਹਾਂਜੀ ਹਾਂਜੀ ਹਾਂਜੀ ਡੈਕੋਰੇਸ਼ਨ ਕੀਤੀ ਹੋਈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਠੀਕ ਉਹ ਕਪਲ ਵਾਈਜ਼ ਜਿੱਦਾਂ ਹਾਂ ਅੱਜ ਕੱਲ੍ਹ ਰਿਵਾਜ਼ ਹੈ ਨਾ ਕਪਲ ਵਾਈਸ ਡਾਂ ਡਾਂਸ ਕਰਦੇ ਹੈ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਠੀਕ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਓਕੇ